ਸਤਿ ਸ਼੍ਰੀ ਅਕਾਲ ਜੀ ਅਮਨ ਟੈਕਸੀ ਸਟੈਂਡ ਤੋਂ ਗੱਲ ਕਰਦੇ ਹੋ ਅਸੀਂ ਇੱਕ ਟੈਕਸੀ ਬੁੱਕ ਕਰੀ ਸੀ ਅਸੀਂ ਖਰੜ ਤੋਂ ਬਿਆਸ ਜਾਣਾ ਹੈ ਉੱਥੇ ਅਸੀਂ ਸਵੇਰੇ ਨੌਂ ਵਜੇ ਪਹੁੰਚਣਾ ਹੈ ਉੱਥੇ ਅਸੀਂ ਸਤਿਸੰਗ ਸੁਣਨਾ ਹੈ ਉੱਥੇ ਪਹੁੰਚਣ ਲਈ ਚਾਰ ਘੰਟੇ ਲੱਗਦੇ ਹਨ ਅਸੀਂ ਤੁਹਾਡੇ ਡਰਾਈਵਰ ਨੂੰ ਚਾਰ ਵਜੇ ਦਾ ਟਾਈਮ ਦਿੱਤਾ ਸੀ ਅਤੇ ਹੁਣ ਸਾਢੇ ਚਾਰ ਹੋ ਗਏ ਹਨ ਤੁਹਾਡੇ ਡਰਾਈਵਰ ਅਜੇ ਤੱਕ ਨਹੀਂ ਪਹੁੰਚਿਆ ਤੁਸੀਂ ਦੱਸੋ ਹੋਰ ਕਿੰਨਾ ਟਾਈਮ ਲੱਗੇਗਾ ਡਰਾਈਵਰ ਨੂੰ ਛੇਤੀ ਭੇਜ ਦਿਓ ਤਾਂ ਕਿ ਅਸੀਂ ਟਾਈਮ ਨਾਲ਼ ਪਹੁੰਚ ਜਾਈਏ ਤੁਹਾਡਾ ਧੰਨਵਾਦ ਜੀ